ਖੇਡਾਂ ਖੇਡਣ ਨਾਲ ਪੇਂਡੂ ਲੋਕਾਂ ਵਿੱਚ ਬਹੁਚਾਰਾ ਭਾਈਚਾਰਾ ਵੱਧਦਾ ਹੈ ਕਿਉਂਕਿ ਪੇਂਡੂ ਲੋਕ ਇੱਕ ਦੂਜੇ ਨੂੰ ਮਿਲਦੇ ਹਨ ਅਤੇ ਭਾਈਚਾਰਾ ਵਧਾਉਂਦੇ ਹਨ ਪੰਜਾਬੀ ਲੋਕ ਤਾਂ ਹੁੰਦੇ ਆ ਜ਼ਿਆਦਾਤਰ ਪੇਂਡੂ ਲੋਕਾਂ ਵਿੱਚ ਪੰਜਾਬੀ ਲੋਕ ਮੈਂ ਗੱਲ ਕਰਾਂ ਮੈਂ ਵੀ ਪੰਜਾਬ ਦਾ ਉੱਥੇ ਇਹੋ ਜਿਹੀਆਂ ਖੇਡਾਂ ਹੁੰਦੀਆਂ ਨੇ ਲੋਕ ਭਲਵਾਨੀ ਕਰਾਉਂਦੇ ਹਨ ਆਪਣਾ ਆਪਣਾ ਭਲਵਾਨ ਉਹ ਮੈਦਾਨ ਵਿੱਚ ਉਤਾਰਦੇ ਹਨ ਅਤੇ ਉਹ ਇਹ ਲੜਾਈ ਦੇ ਤੌਰ 'ਤੇ ਨਹੀਂ ਖੇਡਦੇ ਇਹਨੂੰ ਇਸ ਇੱਕ ਖੇਡ ਦੀ ਤੌਰ 'ਤੇ ਖੇਡਦੇ ਹਨ ਅਤੇ ਆਪਣਾ ਮਨੋਰੰਜਨ ਵੀ ਕਰਦੇ ਹਨ ਅਤੇ ਦੂਜਿਆਂ ਨੂੰ ਸਹੀ ਸੇਧ ਵੀ ਪ੍ਰਦਾਨ ਕਰਦੇ ਹਨ ਕਈ ਅਤੇ ਜਿੰਨੇ ਵੀ ਨੌਜਵਾਨ ਨੇ ਪਿੰਡਾਂ ਦੇ ਵਿੱਚ ਕਈਆਂ ਨੇ ਨਸ਼ੇ ਛੱਡ ਕੇ ਇਹਨਾਂ ਚੀਜ਼ਾਂ ਨੂੰ ਅਪਣਾ ਲਿਆ ਕਿ ਜੋਰ ਦਰੁਸਤੀ ਉਹ ਆਪਣੇ ਸਰੀਰ ਨੂੰ ਦਰੁਸਤ ਕਰਨ ਵਿੱਚ ਲੱਗ ਪਏ ਅਤੇ ਛੋਟੇ ਬੱਚੇ ਵੀ ਇਨ੍ਹਾਂ ਤੋਂ ਬਹੁਤ ਜ਼ਿਆਦਾ ਆਕਰਸ਼ਿਤ ਹੋਏ ਅਤੇ ਉਹ ਵੀ ਇਸ ਲਾਈਨ ਦੇ ਵਿੱਚ ਪੈ ਗਏ ਅਤੇ ਆਪਣੇ ਆਪ ਨੂੰ ਉਹਨਾਂ ਨੇ ਬਹੁਤ ਸਹੀ ਸੇਧ ਦਿੱਤੀ ਅਤੇ ਆਪਣੇ ਤੋਂ ਵੀ ਛੋਟਿਆਂ ਨੂੰ ਉਹ ਪ੍ਰਦਾਨ ਕਰ ਰਹੇ ਨੇ ਇਹ ਸੇਧ ਕਿ ਅਸੀਂ ਐਵੇਂ ਖੇਡ ਰਹੇ ਹਾਂ ਤੁਸੀਂ ਵੀ ਖੇਡੋ ਬੱਚੇ ਆਪਣੇ ਜੇ ਆਪਣੇ ਬੱਚੇ ਆਪਣਾ ਯੂਥ ਸਹੀ ਹੋਏਗਾ ਨਾ ਅੱਗੇ ਆਪਣਾ ਦੇਸ਼ ਤਾਂ ਹੀ ਤਰੱਕੀ ਕਰੇਗਾ ਯੂਥ ਤੋਂ ਬਿਨਾਂ ਤਰ ਦੇਸ਼ ਤਰੱਕੀ ਨਹੀਂ ਕਰ ਸਕਦਾ ਪੇਂਡੂ ਲੋਕਾਂ ਦਾ ਮੇਨ ਆਹ ਹੈ ਕਿ ਬਾਤ ਚੀਤ ਕਰੋ ਗੱਲਬਾਤ ਰਹੋ ਸ਼ਹਿਰਾਂ ਦੇ ਵਿੱਚ ਇੰਨਾ ਮੇਲ ਮਿਲਾਪ ਨਹੀਂ ਹੁੰਦਾ ਜਿੰਨਾ ਪਿੰਡਾਂ ਵਿੱਚ ਭਾਈਚਾਰਾ ਜਦੋਂ ਲੋੜ ਹੋਈ ਇੱਕ ਦੂਜੇ ਨਾਲ ਖੜ ਵੀ ਜਾਂਦੇ ਨੇ